ਰੋਪੜ ਸ਼ਹਿਰ ਦੇ ਵਿੱਚ ਹੋਸਪਿਟਲ ਰਾਹੀਂ ਏ ਐੱਨ ਐੱਮ ਹੈ ਜਿਹੜੀਆਂ ਕਿ ਜਾ ਕੇ ਘਰ ਘਰ ਸਵਾਸਥਯ ਬਾਰੇ ਦੱਸਦੀਆਂ ਹੋਰ ਆਪਣੇ ਇੱਥੇ ਸੰਸਥਾਵਾਂ ਹਨ ਰੋਟਰੀ ਕਲੱਬ ਹੈ ਰੈੱਡ ਕਰੋਸ ਸੋਸਾਇਟੀ ਹੈ ਜਿਹੜੀ ਕਿ ਸਵਾਸਥਯ ਦੇ ਬਾਰੇ ਅਲੱਗ ਅਲੱਗ ਸੁਵਿਧਾਵਾਂ ਟਾਈਮ ਟਾਈਮ 'ਤੇ ਪ੍ਰੋਵਾਈਡ ਕਰਦੀਆਂ